ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਜੀ ਕਿਆ ਹਾਲ ਚਾਲ ਹੈ ਜੀ ਸ਼ਗਨ ਢਾਬੇ ਤੋਂ ਬੋਲਦੇ ਹੋ ਭਾਅ ਜੀ ਮੈਂ ਭਾਅ ਜੀ ਆਪਣੇ ਪਰਿਵਾਰ ਨਾਲ ਆਉਣਾ ਸੀ ਤੁਹਾਡੇ ਕੋਲ ਆਪਣਾ ਜਨਮ ਦਿਨ ਸੈਲੀਬ੍ਰੇਟ ਕਰਨ ਵਾਸਤੇ ਅਤੇ ਮੇਰੇ ਨਾਲ ਮੇਰੇ ਬੱਚੇ ਹੋਉਂਗੇ ਘਰਵਾਲੀ ਹੋਊਗੀ ਭਰਾ ਭੈਣ ਹੋਊਗੇ ਅਤੇ ਮੰਮੀ ਡੈਡੀ ਹੋਊਂਗੇ ਮੈਨੂੰ ਤੁਹਾਡੇ ਕੋਲ ਇੱਥੇ ਅਲੱਗ ਤੋਂ ਕਮਰਾ ਵਗੈਰਾ ਮਿਲ ਸਕਦਾ ਸੇਪਰੇਟ ਤੋਂ ਜੀ ਮੈਂ ਉੱਥੇ ਤੁਹਾਡੇ ਕੋਲ ਰਾਤ ਦਾ ਭੋਜਨ ਵੀ ਖਾਣਾ ਪਸੰਦ ਕਰੂੰਗਾ ਉਹਦੇ ਵਿੱਚ ਮੈਨੂੰ ਦਾਲ ਮੱਖਣੀ ਸ਼ਾਹੀ ਪਨੀਰ ਕੜਾਹੀ ਪਨੀਰ ਰਾਇਤਾ ਤੰਦੂਰੀ ਰੋਟੀ ਰੁਮਾਲੀ ਰੋਟੀ ਮੈਂ ਲੈਣਾ ਪਸੰਦ ਕਰੂੰਗਾ ਅਤੇ ਮਿੱਠੇ ਵਿੱਚ ਮੈਂ ਗੁਲਾਬ ਜਾਮੁਨ ਆਈਸ ਕ੍ਰੀਮ ਵਗੈਰਾ ਲੈਣਾ ਪਸੰਦ ਕਰੂੰਗਾ ਤੁਹਾਡੇ ਭਾਅ ਜੀ ਉੱਥੇ ਪਾਰਕਿੰਗ ਵਾਸਤੇ ਖੁੱਲ੍ਹੀ ਵਿਵਸਥਾ ਹੈਗੀ ਹੈ ਅਤੇ ਤੁਹਾਡਾ ਢਾਬਾ ਬੰਦ ਹੋਣ ਦਾ ਸਮਾਂ ਕੀ ਹੈ ਧੰਨਵਾਦ ਭਾਅ ਜੀ